ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਈਆ ਫਰੀਦਕੋਟ ਤੋਂ ਬਠਿੰਡੇ ਦੀ ਕਿੰਨੀ ਟਿਕਟ ਹੈ ਅੱਛਾ ਜੀ ਠੀਕ ਹੈ ਇੱਕ ਟਿਕਟ ਦੇ ਦਿਓ ਹਾਂਜੀ ਹਾਂਜੀ ਬਠਿੰਡੇ ਹਾਂ

ਭਾਅ ਜੀ ਪਿੱਛੇ ਥੋੜ੍ਹਾ ਜਿਹਾ ਰਸ਼ ਹੈ ਗੰਦੇ ਬੋਇਜ ਬੈਠੇ ਹੋਏ ਡਰਿੰਕ ਕਰਕੇ ਤੁਸੀਂ ਥੋੜ੍ਹਾ ਅੱਗੇ ਕਰ ਦਿੰਦੇ ਹੋ ਸੀਟ ਜਿੱਦਾਂ ਬੈਠਣ ਲਈ ਥੋੜ੍ਹਾ ਜਲਦੀ ਤੋਂ ਜਲਦੀ ਕਰਿਓ ਜੀ ਬਹੁਤ ਦਿੱਕਤ ਹੋ ਰਹੀ ਹੈ ਇੱਥੇ ਹਾਂਜੀ ਹਾਂਜੀ ਆਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਕਿੰਨੇ ਟਾਈਮ 'ਚ ਪਹੁੰਚ ਜਾਏਗੀ ਬਠਿੰਡੇ ਤੱਕ ਅੱਛਾ ਅੱਛਾ ਚਾਰ ਵਜੇ ਤੱਕ ਪਹੁੰਚ ਜਾਏਗੀ ਇੱਥੇ ਉਤਾਰ ਦਿਓ ਤੁਸੀਂ ਬੱਸ ਸਟੈਂਡ 'ਤੇ ਉਤਾਰੋਗੇ ਹਨੁਮਾਨ ਜੋ ਹਨੁੰਮਾਨ ਜੀ ਦੀ ਮੂਰਤੀ ਹੈ ਉੱਥੇ ਅੱਛਾ ਠੀਕ ਏ ਅਤੇ ਅੱਛਾ ਠੀਕ ਹੈ ਔਰ ਅੱਗੇ ਜਾਣਾ ਹੋਏ ਮਾਲ ਰੋਡ ਵਗੈਰਾ 'ਤੇ ਤਾਂ ਤੁਹਾਨੂੰ ਪਤਾ ਕੁਛ ਕਿਵੇਂ ਜਾਣਾ ਹੋਏਗਾ ਅੱਛਾ ਠੀਕ ਏ ਓਕੇ ਔਰ ਵਾਪਸੀ 'ਤੇ ਵੀ ਤੁਸੀਂ ਆਉਂਦੇ ਹੋ ਕੋਈ ਹੈਗਾ ਤੁਹਾਡਾ ਟਾਈਮਿੰਗ ਵਗੈਰਾ ਅੱਛਾ ਇੱਥੋਂ ਹੀ ਚੱਲੇਗੀ ਹਨੁੰਮਾਨ ਚੋਂਕ ਤੋਂ ਹੀ ਚਲੋ ਠੀਕ ਆ ਹੋ ਸਕਿਆ ਤਾਂ ਅਸੀਂ ਆਹੀ ਬੱਸ ਪਕੜ ਲਾਂਗੇ ਫਰੀ ਹੋ ਕੇ ਓ ਬੱਸ ਇੱਦਾਂ ਦੀ ਸਵਾਰੀਆਂ ਤੋਂ ਥੋੜ੍ਹਾ ਧਿਆਨ ਰੱਖਿਆ ਕਰੋ ਕਿ ਕੋਈ ਸ਼ਰਾਬ ਸ਼ਰੁਬ ਨਾ ਪੀਤੀ ਹੋਏ ਕਿਸੇ ਨੇ ਇੱਕ ਸਾਰੀਆਂ ਸਵਾਰੀਆਂ ਫਿਰ ਖਰਾਬ ਹੁੰਦੀਆਂ ਹਾਂਜੀ ਪਰ ਇਹ ਨਾ ਜਨਾਨੀ ਸਵਾਰੀ ਨੂੰ ਬੜੀ ਥੋੜ੍ਹੀ ਦਿੱਕਤ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਧੰਨ ਹਾਂਜੀ ਠੀਕ ਹੈ ਧੰਨੇਆਵਾਦ ਤੁਹਾਡਾ ਠੀਕ ਏ